ਮੇਰਾ ਮਨ ਪਸੰਦ ਐਕਟੀਵਾ ਹੈ ਇਹ ਸਫੈਦ ਰੰਗ ਦੀ ਹੈ ਇਹ ਮੇਰੇ ਮਾਤਾ ਪਿਤਾ ਨੇ ਮੈਨੂੰ ਦੀਵਾਲੀ 'ਤੇ ਗਿਫਟ ਦਿੱਤਾ ਸੀ ਅਤੇ ਇਹ ਬਹੁਤ ਸੁੰਦਰ ਅਤੇ ਆਰਾਮਦਾਇਕ ਹੈ ਇਸ ਤੋਂ ਮੈਂ ਬੈਠ ਕੇ ਸਕੂਲ ਵੀ ਸਮਾਂ ਸਿਰ ਪੁੱਜ ਜਾਂਦੀ ਹਾਂ ਅਤੇ ਮੈਡੀਕਲ ਸ਼ੋਪ ਵੀ ਆਰਾਮ ਨਾਲ ਦਵਾਈ ਲੈਣ ਜਾਂਦੀ ਹਾਂ ਅਤੇ ਮੈਨੂੰ ਸ਼ੋਪਿੰਗ 'ਤੇ ਜਾਣਾ ਹੁੰਦਾ ਹੈ ਅਤੇ ਮੈਂ ਉਸ 'ਚੋਂ ਵੀ ਬੈਠ ਕੇ ਜਾਂਦੀ ਹਾਂ ਇਹ ਇਹ ਇਹ ਬਹੁਤ ਇਸ ਵਿੱਚ ਬੈਠ ਕੇ ਮੈਂ ਆਪਣੇ ਮਾਪਿਆਂ ਨੂੰ ਅਤੇ ਆਪਣੇ ਭਰਾ ਨੂੰ ਮੈਂ ਜਿੱਥੇ ਵੀ ਪੁਜਾਣਾ ਚਾਹੁੰਦੀ ਹਾਂ ਉੱਥੇ ਪੁਜਾ ਦਿੰਦੀ ਹਾਂ ਔਰ ਮੈਨੂੰ ਟਿਊਸ਼ਨ ਜਾਣ ਤੋਂ ਵੀ ਹੀ ਜਾਣ ਤੋਂ ਔਰ ਮੈਨੂੰ ਟਿਊਸ਼ਨ ਜਾਣ ਤੋਂ ਵੀ ਹੈਲਪ ਕਰਦੀ ਹੈ ਇਹ ਔਰ ਮੈਨੂੰ ਬਹੁਤ ਸੁੰਦਰ ਅਤੇ ਵਧੀਆ ਲੱਗਾ ਮੇਰੇ ਮਾਪਿਆਂ ਦਾ ਇਹ ਗਿਫਟ ਮੈਨੂੰ ਬਹੁਤ ਪਸੰਦ ਹੈ ਹੋਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ